ਸਤਿ ਸ਼੍ਰੀ ਅਕਾਲ ਜੀ ਤੁਸੀਂ ਸਿੱਧੂ ਰੈਸਟੋਰੈਂਟ ਰੋਪੜ ਤੋਂ ਬੋਲ ਰਹੇ ਹੋ ਮੈਂ ਤੁਹਾਨੂੰ ਕਈ ਫੋਨ ਕੀਤੇ ਤੁਹਾਡਾ ਫੋਨ ਵੀ ਨਹੀਂ ਲੱਗਿਆ ਅਤੇ ਤੁਹਾਡੇ ਐਪ ਐਪ ਵੀ ਨਹੀਂ ਚੱਲ ਰਿਹਾ ਤੁਹਾਡਾ ਰੈਸਟੋਰੈਂਟ ਖੁੱਲ੍ਹਾ ਹੈ ਜਾਂ ਬੰਦ ਜੇ ਤੁਹਾਡਾ ਰੈਸਟੋਰੈਂਟ ਖੁੱਲ੍ਹਾ ਹੈ ਤਾਂ ਸ਼ਾਹੀ ਪਨੀਰ ਤੰਦੂਰੀ ਰੋਟੀ ਆਈਸਕ੍ਰੀਮ ਖੀਰ ਖੀਰ ਆਰਡਰ ਆਰਡਰ ਭੇਜ ਦਿੱਤਾ ਜਾਵੇ